ਆਪਣੇ ਪਿੰਡ ਦੇ ਸਮਾਜ ਵਿੱਚ ਲੋਕਾਂ ਦੀ ਪਹਿਲੀ ਰਾਏ ਤਾਂ ਇਹ ਹੈ ਜੀ ਕਿ ਸਾਨੂੰ ਨੌਜਵਾਨਾਂ ਨੂੰ ਖੇਡਾਂ ਖੇਡਦੇ ਰਹਿਣਾ ਚਾਹੀਦਾ ਹੈ ਇਹਦੇ ਬਹੁਤ ਫਾਇਦੇ ਹੁੰਦੇ ਹਨ ਜਿਵੇਂ ਲਾ ਲਓ ਕਿ ਸਰੀਰ ਵੱਧਦਾ ਫੁੱਲਦਾ ਹੈ ਸਰੀਰ 'ਚ ਜਾਨ ਆਉਂਦੀ ਹੈ ਅਤੇ ਇਹਦੇ ਵਿੱਚ ਬੰਦਾ ਖੇਡਦਾ ਵੱਧਦਾ ਫੁੱਲਦਾ ਰਹਿੰਦਾ ਹੈ ਅਤੇ ਬਾਹਰ ਹੋਰ ਕਿਤੇ ਨਸ਼ੇ ਵੱਲ ਧਿਆਨ ਨਹੀਂ ਜ ਜਾਂਦਾ ਅਤੇ ਖੇਡਾਂ ਖੇਡਦੇ ਰਹਿ ਰਹਿ ਕੇ ਕਾਫੀ ਲੋਕ ਖੇਡਾਂ ਦੇ ਪੱਧਰ ਤੋਂ ਆਪਣੀਆਂ ਨੌਕਰੀਆਂ 'ਤੇ ਲੱਗੇ ਹੋਏ ਹਨ ਅਤੇ ਨਸ਼ਿਆਂ ਤੋਂ ਦੂਰ ਹਨ ਅਤੇ ਸਾਰੇ ਸਮਾਜ ਦੇ ਨੌਜਵਾਨ ਵੀਰਾਂ ਨੂੰ ਇਹੀ ਬੇਨਤੀ ਹੈ ਕਿ ਖੇਡਾਂ ਖੇਡਦੇ ਰਹੋ ਅਤੇ ਆਪਣਾ ਜੀਵਨ ਸੰਭਾਲਦੇ ਰਹੋ